ਵਿਸਾਖੀ ਸਾਡਾ ਕੌਮੀ ਤਿਹਾਰ ਏ ਇਹ ਸਾਰੇ ਭਾਰਤ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਪਹਿਲੀ ਵਿਸਾਖ ਰਥਵਾਨ ਤੌਰ ਤੇ ਤੇਰਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਸ ਦਾ ਸਬੰਧ ਮੂਲ ਰੂਪ ਵਿੱਚ ਕਣਕ ਦੀ ਫਸਲ ਨਾਲ ਹੈ ਜਿੱਦਾਂ ਵਿਸਾਖੀ ਕਿਸਾਨਾਂ ਦਾ ਤਿਉਹਾਰ ਹੈ ਇਸ ਦਿਨ ਕਿਸਾਨ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰਦੇ ਹਨ ਇਸ ਨੂੰ ਵਾਡੀ ਕਿਹਾ ਜਾਂਦਾ ਹੈ ਜੇਕਰ ਬੇਮੌਸਮੀ ਵਾ ਵਰਖਾ ਕਨ ਵਿਸਾਖੀ ਤੱਕ ਕਨਕ ਪੂਰੀ ਤਰਹਾਂ ਨਾ ਪੱਕੇ ਤਾਂ ਵੀ ਕਣਕ ਦੀ ਫਸਲ ਦੀ ਕਟਾਈ ਰਸਮ ਕੀਤੀ ਜਾਂਦੀ ਹੈ ਵਿਸਾਖੀ ਇੱਕ ਮੌਸਮੀ ਤਿਉਹਾਰ ਵੀ ਹੈ ਕਿ ਗਰਮੀ ਦੀ ਸਿਖਰ ਤੇ ਪਹੁੰਚ ਜਾਂਦਾ ਹੈ ਵਿਸਾਖੀ ਵਿਸ਼ੇਸ਼ ਤੌਰ ਤੇ ਖੇਤੀ ਨਾਲ ਸੰਬੰਧਿਤ ਤਿਉਹਾਰ ਪਰ ਇਸ ਨਾਲ ਇਤਿਹਾਸਿਕ ਘਟਨਾਵਾਂ ਵੀ ਜੁੜ ਗਈਆਂ ਹਨ ਇਸ ਲਈ ਇਹ ਤਿਉਹਾਰ ਦਾ ਇਤਿਹਾਸਿਕ ਮਹੱਤਵ ਹੈ ਸੌਲਾਂ ਸੌ ਨੜਿਨਵੇਂ ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਾਜਨਾ ਕੀਤੀ ਗੁਰੂ ਜੀ ਨੇ ਕੌਮ ਅਤੇ ਧਰਮ ਦੀ ਕੁਰਬਾਨੀ ਦੀ ਭਾਵਨਾ ਦੀ ਪ੍ਰੀਖਿਆ ਲੈ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਇਸ ਤਰ੍ਹਾਂ ਵਿਸਾਖੀ ਦੇ ਤਿਉਹਾਰ ਨਾਲ ਇੱਕ ਦੁੱਖਦਾਇਕ ਘਟਨਾ ਵੀ ਜੁੜੀ ਹੈ ਉੱਨੀ ਸੌ ਉੱਨਵੀਂ ਦੀ ਵਿਸਾਖੀ ਦੀ ਗੱਲ ਹੈ ਜਿਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ

ਬਾਗ ਵਿੱਚ ਇਨਾ ਗੁੰਮਨਾਮ ਸ਼ਹੀਦਾਂ ਦੀ ਇੱਕ ਯਾਦਗਾਰ ਬਣਾਈ ਗਈ ਹੈ ਵਿਸਾਖੀ ਵਾਲੇ ਦਿਨ ਦਿਨ ਪਵਿੱਤਰ ਸਰੋਵਰਾਂ ਵਿੱਚ ਲੋਕ ਇਸ਼ਨਾਨ ਕਰਨ ਜਾਂਦੇ ਹਨ ਲੋਕ ਦੂਰੋਂ ਦੂਰੋਂ ਹਰਿਮੰਦਰ ਸਾਹਿਬ ਆਉਂਦੇ ਹਨ ਵਿਸਾਖੀ ਖੁਸ਼ੀਆਂ ਭਰਿਆ ਮੌਸਮੀ ਤਿਉਹਾਰ ਹੈ ਜੋ ਆਜ਼ਾਦੀ ਦੀ ਰੱਖਿਆ ਦਾ ਪ੍ਰਣ ਲੈਣਾ ਚਾਹੀਦਾ ਹੈ